ਡਾਂਸ ਦਾ ਮੈਨੂੰ ਬਚਪਨ ਤੋਂ ਹੀ ਬਹੁਤ ਸ਼ੌਂਕ ਹੈ ਜਦੋਂ ਵੀ ਮੈਂ ਕਿਤੇ ਦੁਖੀ ਹੁੰਦੀ ਹਾਂ ਜਾਂ ਕੁਛ ਵੀ ਹੈ ਨਾ ਮੈਂ ਡਾਂਸ ਕਰਕੇ ਆਪਣੇ ਆਪ ਨੂੰ ਆਨੰਦ ਮਤਲਬ ਮੈਨੂੰ ਬਹੁਤ ਅੰਦਰੋਂ ਆਨੰਦ ਫੀਲ ਹੁੰਦਾ ਜਦੋਂ ਮੈਂ ਡਾਂਸ ਕਰਦੀ ਹਾਂ ਅੱਜ ਕੱਲ੍ਹ ਤਾਂ ਕੋਈ ਵੀ ਫੰਕਸ਼ਨ ਹੋਵੇ ਕੋਈ ਵਿਆਹ ਸ਼ਾਦੀ 'ਚ ਲੋਕ ਆਪਣਾ ਜਿਹੜੀ ਖੁਸ਼ੀ ਹੈ ਉਹ ਗਿੱਧਾ ਭੰਗੜਾ ਪਾ ਕੇ ਹੀ ਪ੍ਰਗਟ ਕਰਦੇ ਹੈ ਅਤੇ ਮੈਂ ਸ਼ੁਰੂ ਤੋਂ ਹੀ ਨਰਸ਼ਰੀ ਕੇ ਜੀ ਤੋਂ ਡਾਂਸ 'ਚ ਕੋਈ ਵੀ ਸਕੂਲ 'ਚ ਕੋਈ ਪ੍ਰੋਗਰਾਮ ਹੁੰਦਾ ਸੀ ਤਾਂ ਮੈਂ ਹਮੇਸ਼ਾਂ ਹੀ ਪਾਰਟੀਸਪੇਟ ਕੀਤਾ ਅਤੇ ਮੇਰੇ ਘਰਦਿਆਂ ਨੇ ਵੀ ਮੈਨੂੰ ਬਹੁਤ ਉਤਸ਼ਾਹਿਤ ਕੀਤਾ ਇਹਨਾਂ ਡਾਂਸ ਲਈ ਅਤੇ ਡਾਂਸ ਜਦੋਂ ਇਹ ਕਈ ਇਹਨੂੰ ਸੋਲੋ ਪਰਫੋਰਮੈਂਸ ਦਿੰਦੇ ਆ ਡਾਂਸ ਦੀ ਇਕੱਲੀ ਕਰਦੇ ਆਪਣਾ ਆਨੰਦ ਲੈਂਦੇ ਆ ਇਕੱਲੇ ਕਰਕੇ ਪਰ ਜਦੋਂ ਆਪਾਂ ਜਿਹੜਾ ਗਿੱਧਾ ਭੰਗੜਾ ਲੁੱਡੀ ਇਹ ਕਰਦੇ ਹਾਂ ਟੀਮ ਵਰਕ 'ਚ ਕਰਦੇ ਹਾਂ ਤਾਂ ਭਾਈਚਾਰਾ ਬਣਦਾ ਇੱਕ ਅਤੇ ਭਾਈਚਾਰੇ ਦੀ ਭਾਵਨਾ ਜਿਹੜੀ ਵੱਧਦੀ ਹੈ ਜਦੋਂ ਆਪਾਂ ਗਿੱਧਾ ਭੰਗੜਾ ਕਰਦੇ ਹਾਂ ਗਰੁੱਪ ਬਣਾ ਕੇ ਅਤੇ ਫਿਰ ਲੋਕਾਂ ਨੂੰ ਅ ਜਦੋਂ ਭਾਈਚਾਰਾ ਇਕੱਠਾ ਹੁੰਦਾ ਅਤੇ ਅਲੱਗ ਅਲੱਗ ਤਰ੍ਹਾਂ ਦੀ ਦੀਆਂ ਖੁਸ਼ੀ ਪ੍ਰਗਟ ਹੁੰਦੀ ਹੈ ਲੋਕਾਂ ਨੂੰ ਅਤੇ ਇਹਦੇ ਵਿਚ ਜਦੋਂ ਭ ਭਾਈਚਾਰੇ ਦੀ ਭਾਵਨਾ ਵੱਧਦੀ ਹੈ ਇਹ ਜਿਹੜਾ ਗਿੱਧਾ ਏ ਭੰਗੜਾ ਏ ਅਤੇ ਅਲੱਗ ਹੀ ਖੁਸ਼ੀ ਦਿੰਦਾ ਜਿਹੜਾ ਬੰਦਾ ਕਰਦਾ ਏ ਅਤੇ ਜਿਹੜਾ ਬੰਦਾ ਗਿੱਧੇ ਜਾਂ ਭੰਗੜੇ ਨੂੰ ਦੇਖਦਾ ਏ ਉਹਨੂੰ ਵੀ ਬਹੁਤ ਖੁਸ਼ੀ ਹੁੰਦੀ ਏ ਕਿਉਂਕਿ ਇੱਕ ਤਰ੍ਹਾਂ ਦਾ ਗਰੁੱਪ ਜਦੋਂ ਇਹਦੇ 'ਚ ਕਰਦਾ ਅਤੇ ਭਾਈਚਾਰੇ ਦੀ ਭਾਈਚਾਰੇ 'ਚ ਪਿਆਰ ਵੱਧਦਾ ਜਦੋਂ ਆਪਾਂ ਪਿੰਡਾਂ ਜਾਂ ਸ਼ਹਿਰਾਂ ਦੇ ਜੋ ਟੀਮ ਬਣਾਉਂਦੇ ਹਾਂ ਗਿੱਧੇ ਜਾਂ ਭੰਗੜੇ ਦੀ ਅਤੇ ਇਸ ਤਰ੍ਹਾਂ ਡਾਂਸ ਇੱਕ ਬਹੁਤ ਵਧੀਆ ਮਤਲਬ ਹੈ